ਹੈਲੋ ਸਵਿਗੀ ਤੋਂ ਬੋਲਦੇ ਮੈਂ ਨਾ ਤੁਹਾਡੇ ਤੋਂ ਪਹਿਲਾਂ ਇੱਕ ਡਿਸ਼ ਔਡਰ ਕੀਤੀ ਸੀ ਅਤੇ ਉਹ ਮੈਨੂੰ ਬਹੁਤ ਵਧੀਆ ਰਹੀ ਸੀ ਵੀ ਬਹੁਤ ਵਧੀਆ ਤੁਹਾਡਾ ਟੈਸਟੀ ਖਾਣਾ ਸੀ ਵਧੀਆ ਸੀ ਸਾਰਾ ਕੁਛ ਉਹਦਾ ਉਦੋਂ ਮੈਂ ਤੁਹਾਡੇ ਕੋਲੋਂ ਪਹਿਲਾਂ ਦੋ ਪੀਜ਼ੇ ਮੰਗਵਾਏ ਸੀ ਨਾਲ ਦੋ ਬਰਗਰ ਮੰਗਵਾਏ ਸੀ ਅਤੇ ਇੱਕ ਮਨਚੂਰੀਅਨ ਮੰਗਵਾਇਆ ਸੀ ਅਤੇ ਬਹੁਤ ਹੀ ਵਧੀਆ ਸੀ ਜੋ ਮੈਂ ਜਦੋਂ ਔਡਰ ਕੀਤਾ ਉਹਦਾ ਮੈਨੂੰ ਰੇਟ ਵੀ ਬਹੁਤ ਵਧੀਆ ਲੱਗਾ ਤੁਸੀਂ ਬਹੁਤ ਜ਼ਿਆਦਾ ਪੈਸੇ ਨਹੀਂ ਲਾਏ ਸਾਰਾ ਕੁਝ ਇੰਨਾ ਵਧੀਆ ਸੀ ਖਾਣ 'ਚ ਬੜਾ ਵਧੀਆ ਸੀ ਉਹ ਅਤੇ ਇਹ ਸੀ ਕਿ ਬੱਚੇ ਫਿਰ ਜਿੱਦ ਕਰਦੇ ਪਏ ਸੀ ਕਿ ਉੱਥੋਂ ਹੀ ਔਡਰ ਡਿਸ਼ ਔਡਰ ਕਰਨੀ ਆਪਾਂ ਸਵਿਗੀ ਤੋਂ ਹੀ ਤੇ ਸਾਨੂੰ ਮੈਂ ਚਾਹੁੰਦੀ ਆ ਕੀ ਮੇਰਾ ਵੀ ਫਿਰ ਇੱਕ ਡਿਸ਼ ਔਡਰ ਕਰਾਂ ਜਿਵੇਂ ਇੱਕ ਮਲਾਈ ਚਾਂਪ ਹੋ ਗਈ ਇੱਕ ਨਾਲ ਗੁਲਾਬ ਜਾਮੁਨ ਰਸਗੁੱਲੇ ਚਾਹੀਦੇ ਆ ਨਾਲ ਸਾਨੂੰ ਅਤੇ ਇਹ ਆ ਕਿ ਸਾਨੂੰ ਰੇਟ ਵੀ ਠੀਕ ਠੀਕ ਚਾਹੀਦਾ ਬਹੁਤ ਜ਼ਿਆਦਾ ਰੇਟ ਨਹੀਂ ਚਾਹੀਦਾ ਜਿਹਦੇ ਨਾਲ ਮੈਂ ਬਾਅਦ 'ਚ ਔਡਰ ਨਾ ਕਰਾਂ ਇਸ ਕਰਕੇ ਤੁਸੀਂ ਮੈਨੂੰ ਵਧੀਆ ਜੈਨੂਅਨ ਰੇਟ ਦਿਓ ਅਤੇ ਜਲਦੀ ਤੋਂ ਜਲਦੀ ਜਿਹੜਾ ਖਾਣਾ ਵਾ ਉਹ ਸਾਡੇ ਘਰ ਪਹੁੰਚਾਇਆ ਜਾਵੇ ਜਿਹੜਾ ਅਸੀਂ ਡਿਸ਼ ਔਡਰ ਕੀਤੀ ਆ ਅਤੇ ਤੁਸੀਂ ਮੇਰਾ ਔਡਰ ਪਲੀਜ ਲਿਖ ਲਓ ਛੇਤੀ ਤੋਂ ਛੇਤੀ ਮੇਰੇ ਘਰ ਪਹੁੰਚਾ ਦਿਓ